ਅੱਜ ਕੱਲ ਲੋਕ ਸ਼ੇਅਰ ਮਾਰਕੀਟ 'ਚ ਬੜੇ ਪੈਸੇ ਲਗਾ ਰਹੇ ਆ ਜੀ ਮੇਰੇ ਬੱਚੇ ਵੀ ਲਗਾ ਰਹੇ ਸੀ ਔਰ ਮੇਰਾ ਯਾਰ ਬੇਲੀ ਉਹਦੇ ਮੁੰਡੇ ਨੇ ਵੀ ਕਾਫੀ ਪੈਸੇ ਲਾਏ ਜਿਹਦੇ ਵਿੱਚੋਂ ਪੈਸੇ ਆਉਂਦੇ ਘੱਟ ਆ ਜੀ ਅਤੇ ਪੈ ਨੁਕਸਾਨ ਜ਼ਿਆਦਾ ਹੁੰਦਾ ਇਸ ਲਈ ਜਿਹੜੇ ਵੀ ਬੱਚੇ ਸ਼ੇਅਰ ਮਾਰਕੀਟ 'ਚ ਪੈਸਾ ਲਾਉਂਦੇ ਆ ਇਹਦੇ ਨਾਲੋਂ ਕਿਸੇ ਆਪਣੇ ਸਹੀ ਜਗ੍ਹਾ ਪੈਸੇ ਲਗਾਏ ਜਾਣ ਜਿਹਦੇ ਨਾਲ ਤੁਹਾਡੇ ਪੈਸੇ ਸੁਰੱਖਸ਼ਿਤ ਰਹਿਣ ਇਹਦੇ 'ਚ ਹਮੇਸ਼ਾ ਹੀ ਹਾਨੀ ਹੁੰਦੀ ਹੈ ਅਤੇ ਕੋਈ ਫਾਇਦਾ ਨਹੀਂ ਹੁੰਦਾ ਮੇਰੇ ਯਾਰ ਬੇਲੀ ਨੇ ਆਪਣੀ ਤਨਖਾਹ ਦੇ ਪੱਚੀ ਹਜ਼ਾਰ ਰੁਪਈਏ ਇਹਦੇ 'ਤੇ ਲਗਾਏ ਆਪਣੇ ਪਿਓ ਤੋਂ ਚੋਰੀ ਲੇਕਿਨ ਇੱਕ ਵਾਰੀ ਪੰਜ ਹਜ਼ਾਰ ਰੁਪਈਆ ਆਇਆ ਜਿਹਦੇ ਨਾਲ ਅਗਾਂਹ ਉਹਨੂੰ ਲਾਲਚ ਹੋ ਗਿਆ ਉਹਨੂੰ ਉਸਨੇ ਆਪਣੇ ਮਾਲਕ ਕੋਲੋਂ ਦਸ ਹਜ਼ਾਰ ਰੁਪਈਆ ਕਰਜ਼ਾ ਲੈ ਕੇ ਅਤੇ ਸ਼ੇਅਰ ਮਾਰਕੀਟ 'ਚ ਪੈਸੇ ਲਗਾ ਤੇ ਅਤੇ ਆਪਣੇ ਪਿਓ ਨੂੰ ਵੀ ਨਹੀਂ ਦੱਸਿਆ ਉਹਦੇ ਮਾਲਕ ਨੇ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਤੁਹਾਡਾ ਮੁੰਡਾ ਦਸ ਹਜ਼ਾਰ ਰੁਪਇਆ ਲਿਆ ਔਰ ਸ਼ੇਅਰ ਮਾਰਕੀਟ ਵਿੱਚ ਹਾਰ ਗਿਆ ਇਸ ਲਈ ਕਦੀ ਵੀ ਐਨਾ ਸ਼ੇਅਰ ਮਾਰਕੀਟ 'ਚ ਪੈਸੇ ਨਹੀਂ ਲਾਉਣੇ ਚਾਹੀਦੇ ਬਿਲਕੁਲ ਨਹੀਂ ਲਾਉਣੇ ਚਾਹੀਦੇ